ਰਾਸ਼ਟਰੀ ਸਮਾਗਮ ਸਾਡੇ ਜ਼ਿਲ੍ਹੇ ਵਿੱਚ ਪੰਦਰਾਂ ਅਗਸਤ ਜਾਂ ਛੱਬੀ ਜਨਵਰੀ ਨੂੰ ਆਯੋਜਿਤ ਹੁੰਦਾ ਹੈ ਸਮਾਗਮ ਵਿੱਚ ਅਲੱਗ ਅਲੱਗ ਸਕੂਲ ਦੇ ਬੱਚੇ ਭਾਗ ਲੈਂਦੇ ਹਨ ਸਮਾਗਮ ਨੂੰ ਦੇਖਣ ਲਈ ਕਾਫੀ ਅ ਕਾਫੀ ਲੋਕ ਆਉਂਦੇ ਹਨ ਅਤੇ ਦੂਰ ਦੂਰ ਤੋਂ ਵੀ ਆਉਂਦੇ ਹਨ ਇਸ ਨੂੰ ਜੱਜ ਕਰਨ ਲਈ ਚੀਫ਼ ਮਨਿਸਟਰ ਜਾਂ ਡਿਸਟ੍ਰਿਕ ਦਾ ਜੀ ਡੀ ਸੀ ਵੀ ਆਉਂਦਾ ਹੈ